ਸਾਡਾ ਪਸੰਦੀਦਾ ਖੇਡ ਖਿਡਾਰੀ ਹਰਭਜਨ ਸਿੰਘ ਹੈ ਜੋ ਕਿ ਇੱਕ ਕ੍ਰਿਕਟਰ ਹੈ ਜਿਸ ਵਿੱਚ ਸਾਨੂੰ ਕਾਫੀ ਗੁਣ ਪਸੰਦ ਆਏ ਹਨ ਜਿਨ੍ਹਾਂ ਦੇ ਖੇਡਣ ਦਾ ਤਰੀਕਾ ਕਾਫੀ ਵਧੀਆ ਹੈ ਉਹਨਾਂ ਨੇ ਕ ਇਸ ਖੇਡ ਦੀਆਂ ਮੱਲਾਂ ਮਾਰ ਕੇ ਪੰਜਾਬ ਦਾ ਕਾਫੀ ਨਾਮ ਰੋਸ਼ਨ ਕੀਤਾ ਹੈ ਅਤੇ ਅਸੀਂ ਜਦੋਂ ਵੀ ਉਹਨਾਂ ਨੂੰ ਮਿਲਾਂਗੇ ਤਾਂ ਇਸ ਗੱਲ ਬਾਰੇ ਜ਼ਰੂਰ ਪੁੱਛਾਂਗੇ ਕਿ ਉਹਨਾਂ ਦੀ ਸਫਲਤਾ ਦੇ ਪਿੱਛੇ ਕੀ ਰਾਜ ਹੈ